ਸਾਡੇ ਪਿੰਡ ਵਿੱਚ ਕਬਜ਼ ਦੇ ਇਲਾਜ ਲਈ ਇੱਕ ਘਰੇਲੂ ਨੁਸਖਾ ਨਹੀਂ ਬਹੁਤ ਸਾਰੇ ਘਰੇਲੂ ਨੁਸਖੇ ਹਨ ਪਹਿਲਾ ਨੁਸਖਾ ਮਿੱਠਾ ਸੋਡਾ ਖਾਣ ਨਾਲ ਵੀ ਕਬਜ਼ ਦੂਰ ਹੁੰਦੀ ਹੈ ਕਬਜ਼ ਇਸ ਕਿਉਂ ਹੁੰਦੀ ਹੈ ਕਬਜ਼ ਇਸ ਕਰਕੇ ਹੁੰਦੀ ਹੈ ਕਿ ਆਪਾਂ ਜ਼ਿਆਦਾ ਕੰਮ ਨਹੀਂ ਕਰਦੇ ਅਤੇ ਆਲਸ ਪਾਈ ਰੱਖਦੇ ਹਾਂ ਕਬਜ਼ ਨੂੰ ਹਟਾਉਣ ਲਈ ਜਾਂ ਮਿੱਠੇ ਸੋਡੇ ਦੀ ਲੋੜ ਪੈਂਦੀ ਹੈ ਜਾਂ ਫਿਰ ਗਰਮ ਪਾਣੀ ਵਿੱਚ ਸੌਂਫ ਜਾਂ ਅਜਵਾਇਣ ਵੀ ਪਾ ਕੇ ਇਸ ਨੂੰ ਪੀ ਸਕਦੇ ਹਾਂ ਤਾਂ ਜੋ ਪੇਟ ਸਾਫ਼ ਰਹਿੰਦਾ ਹੈ ਅਤੇ ਸਾਨੂੰ ਰੋਜ਼ ਸੈਰ ਕਰਨੀ ਚਾਹੀਦੀ ਹੈ ਤਾਂ ਜੋ ਸਾਨੂੰ ਕਬਜ਼ ਨਾ ਹੋਵੇ ਅਤੇ ਜੋਰ ਵਾਲਾ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਸਾਨੂੰ ਕਬਜ਼ ਨਹੀਂ ਹੁੰਦੀ ਧੰਨਵਾਦ